ਹੈਲੋ ਹਾਂਜੀ ਕਿਆ ਹਾਲ ਹੈ ਜੀ ਹਾਂਜੀ ਮੇਰੀ ਸੰਜੇ ਨਾਲ ਗੱਲ ਹੋ ਰਹੀ ਮੈਨੂੰ ਜੀ ਤੁਹਾਡਾ ਮੇਰੇ ਫਰੈਂਡ ਨੇ ਨੰਬਰ ਦਿੱਤਾ ਅਦਿੱਤਿਆ ਨੇ ਮੈਂ ਬੰਗਲੌਰ ਦਾ ਰਹਿਣ ਵਾਲਾ ਅਤੇ ਮੇਰੀ ਟ੍ਰਾਂਸਫਰ ਹੋਈ ਹੈ ਪੰਜਾਬ 'ਚ ਬਹੁਤ ਬਹੁਤ ਤੁਹਾਨੂੰ ਜੀ ਅਤੇ ਸਰ ਮੈਂ ਤੁਹਾਨੂੰ ਆਹ ਪੁੱਛਣਾ ਤਾ ਜੀ ਮੈਨੂੰ ਨਾ ਨੈਕਸਟ ਮੰਨਥ ਮੈਨੂੰ ਹੋਲੀਡੇਅ ਪੈ ਰਹੀ ਛੁੱਟੀਆਂ ਪੈਣੀਆਂ ਏ ਅਤੇ ਮੈਂ ਆਪਣੀ ਫੈਮਿਲੀ ਨਾਲ ਘੁੰਮਣਾ ਚਾਹੁੰਦਾ ਪੰਜਾਬ 'ਚ ਵਧੀਆ ਵਧੀਆ ਥਾਵਾਂ 'ਤੇ ਤੁਸੀਂ ਮੈਨੂੰ ਸੁਜੈਸਟ ਕਰ ਸਕਦੇ ਕਿਹੜੀ ਕਿਹੜੀ ਥਾਵਾਂ ਨੇ ਨਹੀਂ ਨਹੀਂ ਬਲਾਚੋਰ ਨਹੀਂ ਹੈ ਜੀ ਮੈਂ ਪੂਰਾ ਇਸ ਲੋਕੇਸ਼ਨ 'ਤੇ ਪੂਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਫੈਮਿਲੀ ਨਾਲ ਘੁੰਮਣਾ ਮੈਂ ਕਿਹਾ ਉੱਧਰ ਮਤਲਬ ਰਹਿਣ ਦਾ ਵੀ ਵਧੀਆ ਹੋਵੇ ਘੁੰਮਣ ਨੂੰ ਵੀ ਵਧੀਆ ਹੋਵੇ ਕਰਿਓ ਜੀ ਅੱਛਾ ਜੀ ਤੁਸੀਂ ਆਪ ਗਏ ਤੇ ਕਦੇ ਘੁੰਮਣ ਉੱਧਰ ਜੀ ਅੱਛਾ ਜੀ ਠੀਕ ਹੈ ਜੀ ਵੈਸੇ ਜਦੋਂ ਵੀ ਮੈਨੂੰ ਤੁਹਾਡੀ ਵੈਸੇ ਲੋੜ ਪਈ ਮੈਂ ਤੁਹਾਨੂੰ ਫੋਨ ਕਰ ਲੂੰਗਾ ਹਾਂਜੀ ਮੈਂ ਜ ਜਿਵੇਂ ਹੁਣ ਮੈਂ ਆਉਣਾ ਏ ਇੱਕ ਜਨਵਰੀ ਨੂੰ ਮੈਂ ਇੱਧਰ ਆਉਣਾ ਜੇ ਮੈਨੂੰ ਕਦੇ ਵੀ ਤੁਹਾਡੀ ਲੋੜ ਪਈ ਮੈਂ ਤੁਹਾਨੂੰ ਫੋਨ ਕਰ ਲੂੰਗਾ ਹਾਂਜੀ ਠੀਕ ਆ ਜੀ ਓਕ ਠੀਕ ਆ ਜੀ